ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਜੀ ਠੀਕ ਠਾਕ ਹੋ ਹਾਂਜੀ ਮੈਂ ਨਾ ਤੁਹਾਡੇ ਤੋਂ ਇੱਕ ਸਲਾਹ ਲੈਣਾ ਚਾਹੁੰਦੀ ਸੀ ਵੀ ਤੁਹਾਡੇ ਮੁਤਾਬਿਕ ਹੁਣ ਵਾਲੇ ਦੇਖੋ ਆਪਣੇ ਬੱਚੇ ਵੱਡੇ ਹੋ ਰਹੇ ਨੇ ਹੈ ਨਾ ਅਤੇ ਜਿਹੜਾ ਸ਼ਹਿਰੀ ਜੀਵਨ ਹੈ ਉਹ ਜ਼ਿਆਦਾ ਨਹੀਂ ਵਧੀਆ ਆਪਾਂ ਵੱਡੇ ਸ਼ਹਿਰ 'ਚ ਜਾਈਏ ਉੱਥੇ ਮਤਲਬ ਕਿ ਮੈਨੂੰ ਤਾਂ ਇਹ ਲੱਗਦਾ ਕਿ ਵੱਡੇ ਸ਼ਹਿਰ 'ਚ ਜੋ ਸਹੂਲਤਾਂ ਨੇ ਉਹ ਛੋਟੇ ਸ਼ਹਿਰ ਦੇ ਵਿੱਚ ਜਾਂ ਪਿੰਡ ਦੇ ਵਿੱਚ ਨਹੀਂ ਹੈ ਮੈਨੂੰ ਤਾਂ ਸਭ ਤੋਂ ਪਹਿਲਾਂ ਨਾ ਇੱਕ ਗੱਲ ਦੀ ਖਿੱਚ ਰਹਿੰਦੀ ਹੈ ਕਿ ਇੱਕ ਤਾਂ ਉੱਥੇ ਬਿਜਲੀ ਦਾ ਬਿੱਲ ਬਹੁਤ ਘੱਟ ਆਉਂਦਾ ਦੂਜਾ ਬਿਜਲੀ ਜਾਂਦੀ ਨਹੀਂ ਤੀਸਰਾ ਜਿਹੜੀ ਆਪਣੀ ਸਿਹਤ ਵਿਭਾਗ ਵੱਲੋਂ ਜਿਹੜੀਆਂ ਸਹੂਲਤਾਂ ਸ਼ਹਿਰਾਂ 'ਚ ਦਿੱਤੀਆਂ ਜਾਂਦੀਆਂ ਉਹ ਆਪਣੇ ਛੋਟੇ ਸ਼ਹਿਰਾਂ 'ਚ ਨਹੀਂ ਹੈਗੀਆਂ ਸਭ ਤੋਂ ਵੱਡੀ ਗੱਲ ਜਦੋਂ ਆਪਾਂ ਵੱਡੀ ਉਮਰ ਦੇ ਵਿੱਚ ਜਾਂਦੇ ਹਾਂ ਸਾਨੂੰ ਹੈ ਨਾ ਪਹਿਲਾਂ ਹ ਹੋਸਪਿਟਲ ਵਧੀਆ ਡਾਕਟਰਾਂ ਦੀ ਲੋੜ ਪੈਂਦੀ ਪੈਂਦੀ ਹੈ ਫਿਰ ਉੱਥੇ ਇੰਨੇ ਸੋਹਣੇ ਪਾਰਕ ਬਣੇ ਹੋਏ ਨੇ ਹੈ ਨਾ ਪਾਰਕ ਦੇ ਵਿੱਚ ਕਿੰਨੇ ਵਧੀਆ ਜਿਮ ਬਣੇ ਹੋਏ ਨੇ ਕਿ ਆਪਾਂ ਸਵੇਰੇ ਸੈਰ ਕਰੀਏ ਫਿਰ ਆਪਣੇ ਵਰਗੇ ਪੜ੍ਹੇ ਲਿਖੇ ਲੋਕਾਂ ਦਾ ਹੀ ਕਰਾਊਡ ਹੈ ਉੱਥੇ ਜਿਨਾਂ ਨੂੰ ਆਪਾਂ ਸਮਝਾਉਣਾ ਡਿਫਰੈਂਟ ਬਣਾਉਣਾ ਬਹੁਤ ਆਸਾਨ ਸਮਝਦੇ ਹਾਂ ਬਾਕੀ ਸ਼ਹਿਰਾਂ ਦੀ ਤੁਲਨਾ ਦੇ ਵਿੱਚ ਵੱਡੇ ਸ਼ਹਿਰ ਜ਼ਿਆਦਾ ਵਧੀਆ ਨਹੀਂ ਹੈ ਤੁਹਾਡੇ ਹਿਸਾਬ ਨਾਲ ਹਾਂ ਅੱਛਾ ਉਥੇ ਰੁਜ਼ਗਾਰ ਦੇ ਮੌਕੇ ਵੀ ਬਹੁਤ ਵਧੀਆ ਨੇ ਤੁਸੀਂ ਕੋਈ ਵੀ ਛੋਟਾ ਕੰਮ ਕੋਈ ਵੀ ਵੱਡਾ ਕੰਮ ਜਿਸ ਤਰ੍ਹਾਂ ਦਾ ਵੀ ਕੰਮ ਤੁਸੀਂ ਚਾਹੁੰਦੇ ਹੋ ਤੁਹਾਨੂੰ ਆਰਾਮ ਦੇ ਨਾਲ ਮਿਲਣ ਦੇ ਜਿਹੜੇ ਹੈਗੇ ਆ ਮੌਕੇ ਬਹੁਤ ਜ਼ਿਆਦਾ ਹੁੰਦੇ ਨੇ ਹੁੰ ਹੁੰ ਹੁੰ ਹੁੰ ਹਾਂਜੀ ਹਾਂਜੀ ਹਾਂਜੀ ਅਤੇ ਮੈਨੂੰ ਹਮੇਸ਼ਾ ਇਹ ਲੱਗਦਾ ਹੁੰਦਾ ਕਿ ਜਿਹੜਾ ਆਪਣੀ ਜਿਵੇਂ ਹੁਣ ਆਪਾਂ ਚਾਹੁੰਦੇ ਆ ਕਿ ਆਪਾਂ ਮੋਹਾਲੀ ਰਹੀਏ ਮੋਹਾਲੀ ਵਰਗਾ ਸ਼ਹਿਰ ਬਹੁਤ ਵਧੀਆ ਹੈ ਨਾ ਕੀ ਮੇਰਾ ਫੈਸਲਾ ਸਹੀ ਹੈ ਠੀਕ ਹੈ ਠੀਕ ਹੈ ਜੀ ਥੈਂਕ ਯੂ ਥੈਂਕ ਯੂ ਸੋ ਮੱਚ ਧੰਨਵਾਦ ਤੁਹਾਡਾ ਬਹੁਤ ਬਹੁਤ ਸਤਿ ਸ਼੍ਰੀ ਅਕਾਲ